ਜਿਹੜੀ ਮਤਲਬ ਪੰਜਾਬੀ ਭਾਸ਼ਾ ਵਿੱਚ ਮੈਂ ਅਖਬਾਰ ਦੀ ਗੱਲ ਕਰਾਂ ਤਾਂ ਜਿਹੜੀ ਜਗਬਾਣੀ ਹੈਗੀ ਉਹ ਮੇਰੀ ਮਤਲਬ ਮਨਪਸੰਦ ਅਖਬਾਰਾਂ ਵਿੱਚ ਆਉਂਦੀ ਹੈ ਅਖਬਾਰਾਂ ਵਿੱਚੋਂ ਇੱਕ ਹੈ ਕਿਉਂਕਿ ਮੈਨੂੰ ਮਤਲਬ ਜੇ ਆਪਾਂ ਗੱਲ ਕਰੀਏ ਪੁਰਾਣੀ ਗੱਲ ਵੀ ਕਰ ਲਈਏ ਨਵੀਂ ਗੱਲ ਵੀ ਕਰ ਲਈਏ ਮੈਨੂੰ ਕਿਸੇ ਵੀ ਜਦੋਂ ਖਬਰ ਬਾਰੇ ਕਈ ਵਾਰੀ ਆਪਾਂ ਨੂੰ ਇੰਗਲਿਸ਼ ਅਖਬਾਰ ਸਮਝ ਨਹੀਂ ਆਉਂਦੀ ਤਾਂ ਜਿਹੜੀ ਪੰਜਾਬੀ ਅਖਬਾਰ ਆ ਉਹ ਮੇਰੀ ਮਦਦ ਕਰਦੀ ਹੈ ਵੀ ਇਸ ਗੱਲ ਵਿੱਚ ਮਦਦ ਕਰਦੀ ਮੈਂ ਮਤਲਬ ਸਮਝ ਸਕਾਂ ਵੀ ਗੱਲ ਕੀ ਚੱਲ ਰਹੀ ਹੈ ਆਪਣਾ ਮਾਹੌਲ ਕੀ ਚੱਲ ਰਿਹਾ ਅਖਬਾਰ ਵਿੱਚ ਮੈਂ ਉਹਦੇ ਵਿੱਚ ਜਿਹੜੇ ਪਿੱਛੇ ਐਕਟਰ ਊਕਟਰ ਬਾਰੇ ਕਈ ਵਾਰ ਦਿੱਤਾ ਹੁੰਦਾ ਉਹ ਵੀ ਪੜ੍ਹ ਲੈਂਦੀ ਆ ਜਿਹੜਾ ਸਮੇਂ ਦੀ ਸਰਕਾਰ ਦੀ ਐਕਟੀਵਿਟੀਜ ਹੈ ਉਹਨਾਂ ਬਾਰੇ ਮੈਨੂੰ ਇਸ ਖਬਰ ਮਿਲਦੀ ਪਰ ਕਦੇ ਇੱਦਾਂ ਨਹੀਂ ਲੱਗਿਆ ਵੀ ਉਹਨਾਂ ਨੇ ਕਦੇ ਝੂਠ ਐਕਸਪ੍ਰੈਸ ਕੀਤਾ ਹੁੰਦਾ ਸੱਚ ਹੀ ਲਗ ਮਤਲਬ ਸੱਚ ਹੀ ਹੁੰਦਾ ਜਦੋਂ ਵੀ ਅ ਮਤਲਬ ਅਖਬਾਰ ਦੀ ਗੱਲ ਨੂੰ ਅਗਰ ਮੈਂ ਰੀਅਲ ਲਾਈਫ ਨਾਲ ਜਦੋਂ ਦੇਖਦੀ ਹਾਂ ਮੈਂ ਅਸਲੀਅਤ ਵਿੱਚ ਵੀ ਹਾਂ ਵੀ ਅੱਛਾ ਇਹ ਚੀਜ਼ ਸੱਚੀ ਵਿੱਚ ਹੋਈ ਹੈ ਉਹ ਬਿਲਕੁਲ ਸੱਚ ਹੁੰਦਾ ਉਹਦੀ ਸਮੇਂ ਦੀ ਤਸਵੀਰਾਂ ਆਈਆਂ ਹੁੰਦੀਆਂ ਨੇ ਅਖਬਾਰ ਵਿੱਚ ਅਤੇ ਹਰ ਇੱਕ ਚੀਜ਼ ਦਾ ਐਵੀਡੈਂਸ ਨਾਲ ਰੱਖਿਆ ਲੱਗਿਆ ਹੁੰਦਾ ਇੱਦਾਂ ਨਹੀਂ ਕਿ ਵੀ ਕੋਈ ਵੀ ਗੱਲ ਮਿਲੀ ਬਣਾ ਕੇ ਕਰ ਦਿੱਤੀ ਕਾਫੀ ਜ਼ਿਆਦਾ ਵਧੀਆ ਲੱਗਦਾ ਜਦੋਂ ਜਦੋਂ ਮੈਂ ਅਖਬਾਰ ਪੜ੍ਹਦੀ ਹਾਂ ਅਸੀਂ ਸਪੈਸ਼ਲ ਅਖਬਾਰ ਲਗਵਾਈ ਵੀ ਸੀ ਫਿਰ ਹੁਣ ਔਨਲਾਈਨ ਅਖਬਾਰ ਪੜ੍ਹ ਲੈਂਦੀ ਹੁੰਦੀ ਹਾਂ ਅਤੇ ਉਹਦੇ ਨਾਲ ਇੱਦਾਂ ਹੀ ਹੁੰਦਾ ਵੀ ਅ ਬੰਦਾ ਅਪ ਟੂ ਡੇਟ ਰਹਿੰਦਾ ਵੀ ਹਾਂ ਬੀ ਵੀ ਮੈਨੂੰ ਪਤਾ ਵੀ ਮੇਰੇ ਜਿਹੜਾ ਮਤਲਬ ਕੀ ਚੱਲ ਰਿਹਾ ਆਲੇ ਦੁਆਲੇ ਅਤੇ ਮਤਲਬ ਅਖਬਾਰਾਂ ਤੋਂ ਬਿਨਾਂ ਤਾਂ ਇਹ ਸਭ ਕੁਛ ਪੋਸੀਬਲ ਹੀ ਨਹੀਂ ਹੈ ਜੇ ਆਪਾਂ ਔਨਲਾਈਨ ਵੀ ਪੜ੍ਹ ਓਹ ਵੀ ਅਖਬਾਰ ਦੀ ਹੀ ਫੋਟੋ ਪੜ੍ਹ ਰਹੇ ਹਾਂ ਇਹ ਅਖਬਾਰ ਹੀ ਹੈ ਜਿਹਨੂੰ ਆਪਾਂ ਪੜ੍ਹ ਰਹੇ ਹਾਂ ਇੱਦਾਂ ਕਦੇ ਵੀ ਹੋ ਮਤਲਬ ਆਪਾਂ ਬਿਨਾਂ ਆਲੇ ਦੁਆਲੇ ਦੀ ਖਬਰ ਤੋਂ ਨਾ ਆਪਾਂ ਫਿਰ ਮਤਲਬ ਪੜ੍ਹੇ ਲਿਖੇ ਅਨਪੜ੍ਹ ਹੋ ਜਾਂਦੇ ਆ ਤਾਂ ਮੇਰੀ ਮਤਲਬ ਇਹ ਦੱਸਾਂਗੀ ਵੀ ਜਗਬਾਣੀ ਜਿਹੜੀ ਹੈਗੀ ਵਧੀਆ ਹੈਗੀ ਉਹਦੀ ਹਾਈਲਾਈਟਸ ਤੋਂ ਜਿਹੜੇ ਆ ਉੱਪਰ ਮੇਨ ਹੈਡਿੰਗ ਲਿਖੀਆਂ ਹੁੰਦੀਆਂ ਮੈਂ ਅੱਗੇ ਦੀ ਖਬਰ ਪੜ੍ਹ ਲੈਂਦੀ ਹਾਂ ਅਤੇ ਕਾਫੀ ਵਧੀਆ ਰਹਿੰਦਾ ਮੇਰੇ ਇਸ ਅਖਬਾਰ ਨੂੰ ਪੜ੍ਹਨ ਦਾ ਰੁਝਾਨ ਅਤੇ ਪੰਜਾਬੀ ਭਾਸ਼ਾ ਵਿੱਚ ਜਿਹੜੀ ਛਪੀ ਹੁੰਦੀ ਹੈ ਮੈਨੂੰ ਵਧੀਆ ਲੱਗਦੀ ਹੈ ਬਹੁਤ ਜ਼ਿਆਦਾ ਅਤੇ ਕੋਈ ਮਤਲਬ ਉਹ ਨਹੀਂ ਹੈ ਵੀ ਇੰਨਾਂ ਔਖਾ ਵੀ ਨਹੀਂ ਹੈ ਅਖਬਾਰ ਨੂੰ ਪੜ੍ਹਨਾ ਜਾਂ ਖਰੀਦਣਾ ਪੰਜ ਰੁਪਏ ਦੀ ਅਖਬਾਰ ਆ ਜਾਂਦੀ ਹੈ ਇੱਕ ਵਧੀਆ ਹੁੰਦਾ ਹੈ ਜੀ ਧੰਨਵਾਦ ਜੀ